ਹਾਲਾਂਕਿ ਪੰਜਾਬ ਨੂੰ ਖੇਤੀਬਾੜੀ ਅਤੇ ਵਪਾਰ ਲਈ ਜਾਣਿਆ ਜਾਂਦਾ ਹੈ ਪਰ ਆਖਰੀ ਕੁਝ ਸਾਲਾਂ 'ਚ ਆਈ ਟੀ ਅਤੇ ਟੈਕਨੋਲੋਜੀ ਖੇਤਰ 'ਚ ਵੀ ਬਹੁਤ ਵਿਕਾਸ ਹੋਇਆ ਹੈ ਇਹ ਪੰਜਾਬ ਵਿੱਚ ਮੁੱਖ ਟੈਕਨੋਲੋਜੀ ਕਰੀਅਰ ਦਾ ਸੰਭਾਵਨਾ ਕਈ ਕਈ ਵੱਧ ਗਈਆਂ ਹਨ ਨਵੇਂ ਸਟਾਰ ਜਿੱਦਾਂ ਕਿ ਨਵੇਂ ਸਟਾਰਟਅਪਸ ਆਈ ਟੀ ਪਾਰਕਸ ਅਤੇ ਵੱਡੀਆਂ ਐਮ ਐਨ ਸੀਜ ਨੇ ਪੰਜਾਬ ਤੱਕ 'ਚ ਪੈਰ ਪਸਾਰ ਰਹੇ ਹਨ ਜਿਸ ਨਾਲ ਟੈਕ ਪ੍ਰੋਫੈਸ਼ਨਲਸ ਲਈ ਵਧੀਆ ਨੌਕਰੀਆਂ ਉਪਲੱਬਧ ਹੋ ਰਹੀਆਂ ਹਨ ਜਿੱਦਾਂ ਕਿ ਸੋਫਟ ਡਿਵੈਲਪਮੈਂਟ ਪੰਜਾਬ 'ਚ ਸੋਫਟ ਡਿਵੈਲਪਮੈਂਟ ਦੀ ਡਿਮਾਂਡ ਦਿਨੋਂ ਦਿਨ ਵੱਧ ਰਹੀ ਹੈ ਪਾਈਟਨ ਡਿਵੈਲਪਰ ਜਾਵਾ ਡਿਵੈਲਪਰ ਫੁੱਲ ਸਟੈਕ ਡਿਵੈਲਪਰ ਵਰਗੀਆਂ ਨੌਕਰੀਆਂ ਹਨ ਅਤੇ ਖੇਤਰ 'ਚ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹਦੀ ਤਨਖਾਹ ਤਿੰਨ ਤੋਂ ਬਾਰ੍ਹਾਂ ਐਲ ਪੀ ਏ ਤੋਂ ਹੁੰਦੀ ਹੈ ਮੁੱਖ ਹੁਨਰ ਹੈ ਪਾਈਥਨ ਜਾਵਾ ਸਕਰਿਪਟ ਮੰਗ ਆਈ ਟੀ ਕੰਪਨੀ ਈਕਮਰਸ ਫਾਈਨ ਟੈਕ ਵਰਗੀਆਂ ਕੰਪਨੀਆਂ ਸਾਸ ਕੰਪਨੀਆਂ ਇਹ ਸੋਫਟਵੇਅਰ ਡਿਵੈਲਪਮੈਂਟ ਨੂੰ ਅੱਗੇ ਵਧਾਉਣ ਵਿੱਚ ਕੰਮ ਕਰਦੀਆਂ ਹਨ ਦੂਜੀ ਏ ਆਰ ਪੀ ਐਮ ਬਿਜਨਸ ਸਲਿਊਸ਼ਨ ਸਾਪ ਦੀ ਡਿਮਾਂਡ ਏ ਆਰ ਪੀ ਅਤੇ ਸਾਪਸ ਕੰਨਸੈਲਟੈਂਟ ਲਈ ਆਈ ਟੀ ਨੇ ਪ੍ਰੋਡਕਸ਼ਨ ਕੰਪਨੀਆਂ ਵੱਲੋਂ ਵੱਧੀਆਂ ਵਧੀਆ ਮੌਕੇ ਹਨ ਸਾਪ ਫਿਕੋ ਸਾਪ ਐਮ ਐਮ ਅਤੇ ਸਾਪ ਏ ਵੈਬ ਵਿੱਚ ਨਿਪੁੰਨ ਵਿਅਕਤੀਆਂ ਲਈ ਹਾਈ ਪੇਇੰਗ ਜੋਬਸ ਉਪਲੱਬਧ ਹਨ ਇਹਦੀ ਤਨਖਾਹ ਛੇ ਤੋਂ ਬਾਰਾਂ ਐਲ ਪੀ ਹਨ ਹੁਨਰ ਐਸ ਪੀ ਐਮ ਮਾਡਲਸ ਈ ਆਰ ਪੀ ਇੰਪਲੀਮੈਂਟੇਸ਼ਨ ਬਿਜਨਸ ਐਰਟਿਕਸ ਅਤੇ ਕਈ ਸਾਰੀਆਂ ਹੁਨਰ ਹਨ ਮੰਗ ਐਮ ਐਨ ਸੀਜ਼ ਕੰਪਨੀ ਮੈਨੁਫੈਕਚਿੰਗ ਕੰਪਨੀਸ ਅਤੇ ਸਹਿਕਾਰੀ ਕੰਪਨੀਆਂ ਇਹ ਇਹ ਇਹ ਘੜੀਆਂ ਨੂੰ ਚੂਜ ਕਰਦੀਆਂ ਹਨ ਸਾਈਬਰ ਸਕਿਓਰਟੀ ਐਂਡ ਐਟੀਕਲ ਲੈਕਿੰਗ ਡਿਜੀਟਾਈਲੇਸ਼ਨ ਵਧਣ ਨਾਲ ਸਾਈਬਰ ਸਕਿਓਰਟੀ ਐਨਲਿਸਟ ਹੈਟੀਕਲ ਆਈਕਲਸ ਦੀ ਮੰਗ ਵੀ ਵੱਧ ਰਹੀ ਹੈ ਬੈਂਕਸ ਆਈ ਟੀ ਫੋਰਮਸ ਅਤੇ ਗਵਰਮੈਂਟ ਆਰਗਨਾਈਜੇਸ਼ਨ ਔਰਗਨਾਈਜੇਸ਼ਨ ਨੂੰ ਆਪਣੇ ਡਾਟਾ ਅਤੇ ਸਕਿਓਰ ਕਰਮ ਕਰਨ ਲਈ ਸਾਈਬਰ ਸਕਿਓਰਟੀ ਐਸਪਰਸ ਦੀ ਲੋੜ ਹੁੰਦੀ ਹੈ ਅਤੇ ਇ ਇਸ ਨਾਲ ਇਸ ਇਸ ਨਾਲ ਪੰਜਾਬ ਹੁਣ ਸਿਰਫ ਉਦਯੋਗ ਅਤੇ ਵਪਾਰ ਦਾ ਹ ਹਤੀ ਨਹੀਂ ਮੰਗੋ ਆਈ ਟੀ ਤੇ ਅਤੇ ਟੈਕਨੋਲੋਜੀ ਦ ਦੀ ਕਈ ਨਵੀਂ ਮ ਮੰਜਿਲ ਬਣ ਰਿਹਾ ਹੈ ਪਾਈਟਨ ਏ ਆਈ ਕਲਾਊਡ ਕੰਪਿਊਟਿੰਗ ਸਾਈਬਰ ਸਕਿਓਰਟੀ ਵਰਗੀਆਂ ਸਕਿਲਸਿਸ ਨਾਲ ਪੰਜਾਬ ਯੁਵਾ ਹਾਈਪਿੰਗ ਆਈ ਟੀ ਕਰੀਅਰ ਵਿੱਚ ਦਾਖਲ ਹੋ ਰਹੇ ਹਨ ਧੰਨਵਾਦ